ਮੈਂ ਕਦੇ ਪਹਾੜੀ ਇਲਾਕੇ 'ਚ ਜਾਂ ਕਿਤੇ ਵੀ ਘੁੰਮਿਆ ਨਹੀਂ ਮੈਂ ਜਾਂ ਸਮੁੰਦਰ ਦੇ ਕੁਮਾਰੇ ਜੀ ਅਤੇ ਮੈਂ ਗੁਰਦੁਆਰਾ ਸਾਹਿਬ ਜਾਣਾ ਪਸੰਦ ਕਰਦਾ ਅਤੇ ਆਪਣੇ ਬੱਚਿਆਂ ਨੂੰ ਮੈਂ ਹਰ ਐਤਵਾਰ ਨੂੰ ਸਵੇਰੇ ਸ਼ਾਮ ਜਦ ਵੀ ਸਮਾਂ ਲੱਗਦਾ ਜੀ ਮੈਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰੀਦੀ ਆ ਅਤੇ ਪ੍ਰਸ਼ਾਦਾ ਪਾਣੀ ਵੀ ਛਕੀਦਾ ਏ ਅਤੇ ਆਪਣੇ ਰਿਸ਼ਤੇਦਾਰਾਂ ਲਈ ਮਠਿਆਈ ਮਠਿਆਈ ਲੈ ਕੇ ਵੀ ਮੈਂ ਜਾਨਾ ਏ ਜੀ ਅਤੇ ਗੱਲਾਂ ਬਾਤਾਂ ਵੀ ਮੇਰੇ ਰਿਸ਼ਤੇਦਾਰਾਂ ਨਾਲ ਵਿਚਾਰ ਸਾਂਝੇ ਕਰੀਦੇ ਆ ਅਤੇ ਮਜ਼ਾਕ ਕਰੀਦਾ ਜੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਜੀ ਗੁਰਦੁਆਰਾ ਸਾਹਿਬ 'ਚ ਬਹੁਤ ਵਧੀਆ ਸੇਵਾ ਕਰਦੇ ਹਾਂ ਜੀ ਅਸੀਂ ਜਾ ਕੇ ਅਤੇ ਬਹੁਤ ਜੀ ਲੱਗਦਾ ਜੀ